ਦੁਨੀਆਂ ਦੀ ਅੱਧੀ ਵਸੋਂ ਭਾਵੇਂ ਔਰਤਾਂ ਦੀ ਹੈ ਉਹਨਾਂ ਦੀ ਪਛਾਣ ਮਾਂ ਭੈਣ ਪਤਨੀ ਬੇਟੀ ਕਰਕੇ ਹੈ ਇਨਸਾਨ ਕਰਕੇ ਨਹੀਂ ਸਮਾਜ ਵਿੱਚਲੀਆਂ ਕੁਝ ਚੇਤਨ ਇਸਤਰੀਆਂ ਨੇ ਆਪਣੀ ਪਛਾਣ ਆਪ ਬਣਾ ਲਈ ਹੈ ਦੇਸ਼ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਅਤੇ ਇਹ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਪਾ ਰਹੀਆਂ ਹਨ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿੱਤੀ ਗਈ ਹੈ ਕਿ ਉਹਨਾਂ ਦੀ ਸਮਝ ਅਧੂਰੀ ਹੈ ਉਹ ਆਪਣੇ ਨਿਰਣੇ ਆਪ ਨਹੀਂ ਲੈ ਸਕਦੀਆਂ ਉਹਨਾਂ ਦੀ ਅਕਲ ਗੁੱਤ ਗੁੱਤ ਪਿੱਛੇ ਹੈ ਇੱਥੇ ਇਹ ਗੱਲ ਬਿਲਕੁਲ ਭੁੱਲ ਜਾਂਦੀ ਹੈ ਕਿ ਔਰਤ ਦੇ ਵਿਕਾਸ ਵਿੱਚ ਸਮਾਜ ਦੀ ਕੀ ਭੂਮਿਕਾ ਹੈ ਅਜੋਕੇ ਸਮੇਂ ਵਿੱਚ ਜਦੋਂ ਅਸੀਂ ਆਪਣੇ ਦੇਸ਼ ਵੱਲ ਝਾਤੀ ਮਾਰਦੇ ਹਾਂ ਇਹ ਦੇਖਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਔਰਤ ਮਰਦ ਦੇ ਮੁਕਾਬਲੇ ਪਿੱਛੇ ਨਹੀਂ ਸਗੋਂ ਉਹ ਮਰਦ ਦੇ ਮੁਕਾਬਲੇ ਅਤੇ ਆ ਖੜ੍ਹੀ ਹੋਈ ਹੈ ਉਹ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੈ ਉਹ ਪ੍ਰਸ਼ਾਸਨ ਫੌਜ ਪੁਲਿਸ ਅਤੇ ਹੋਰ ਖੇਤਰਾਂ ਵਿੱਚ ਮੋਹਰੀ ਹੋ ਕੇ ਕੰਮ ਕਰ ਰਹੀ ਹੈ ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਵੀ ਖੁਦ ਔਰਤ ਹੀ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਔਰਤਾਂ ਦੀਆਂ ਸਮੱਸਿਆਵਾਂ ਇੰਨੀਆਂ ਬਹੁ ਪਰਤੀ ਬਹੁ ਦਿਸ਼ਾਵੀ ਬਹੁ ਆਦੀ ਬਹੁ ਪੱਖੀ ਬਹੁ ਰੂਪੀ ਹਨ ਜਿਹਨਾਂ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ ਇਤਿਹਾਸ ਗਵਾਹ ਹੈ ਕਿ ਔਰਤ ਦੀ ਸਥਿਤੀ ਸ਼ੁਰੂ ਤੋਂ ਨਾਗਰਿਕ ਵਾਲੀ ਨਹੀਂ ਰਹੀ ਹੈ ਮੁੱਢਲੇ ਕਬੀਲੇ ਯੁੱਗ ਵਿੱਚ ਮਾਤਰੀ ਪ੍ਰਧਾਨ ਸਮਾਜ ਸੀ ਉਸ ਸਮੇਂ ਔਰਤ ਦਾ ਰੁਤਬਾ ਬਹੁਤ ਹੀ ਸਨਮਾਨਯੋਗ ਸੀ ਜਦੋਂ ਮਨੁੱਖ ਨੇ ਨਿੱਜੀ ਜਾਇਦਾਦ ਰੱਖਣੀ ਸ਼ੁਰੂ ਕਰ ਦਿੱਤੀ ਇਹ ਸਥਿਤੀ ਉਸ ਸਮੇਂ ਤੋਂ ਹੀ ਪਲਟਾ ਖਾ ਜਾਂਦੀ ਹੈ ਜਿਸ ਦਾ ਪ੍ਰਗਟਾਵਾ ਸੰਮਤੀ ਯੁੱਗ ਵਿੱਚ ਸਾਹਮਣੇ ਆ ਜਾਂਦਾ ਹੈ ਪੈਦਾਵਰੀ ਸਾਧਨਾਂ 'ਤੇ ਮਰਦ ਦਾ ਕੰਟਰੋਲ ਹੋ ਜਾਂਦਾ ਹੈ ਮਰਦ ਦੇ ਕਬਜ਼ੇ ਹੇਠ ਜਾਇਦਾਦ ਆਉਣ ਨਾਲ ਹਰ ਪਾਸੇ ਉਹਦੀ ਸਰਦਾਰੀ ਕਾਇਮ ਹੋ ਜਾਂਦੀ ਹੈ ਔਰਤ ਦੀ ਸਥਿਤੀ ਪਹਿਲੀ ਸਥਿਤੀ ਤੋਂ ਮੋੜ ਲੈ ਜਾਂਦੀ ਹੈ ਅਤੇ ਉਹ ਮਰਦ ਦੇ ਅਧੀਨ ਹੋ ਜਾਂਦੀ ਹੈ ਪੂੰਜੀਵਾਦੀ ਆਰਥਿਕਤਾ ਦੇ ਆਉਣ ਨਾਲ ਔਰਤ ਦੀ ਸਥਿਤੀ ਵਿੱਚ ਕੁਝ ਬੁਨਿਆਦੀ ਪਰਿਵਰਤਨ ਤਾਂ ਆਉਂਦਾ ਹੈ ਛੋਟੇ ਮੋਟੇ ਕੰਮਾਂ ਲਈ ਘੱਟ ਵੇਤਨ ਦੇਣ ਵਾਸਤੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਹਨ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਉਹ ਕੁਝ ਕਮਾ ਕੇ ਸਵੈ ਨਿਰਭਰ ਹੋ ਜਾਂਦੀਆਂ ਹਨ ਉਹ ਇਹਨਾਂ ਦੀ ਆਰਥਿਕ ਸਵੈ ਨਿਰਭਰਤਾ ਹੈ ਸਮਾਜਿਕ ਨਹੀਂ ਮੁੱਢ ਕਦੀਮ ਤੋਂ ਹੀ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਆਪਣੀਆਂ ਜੰਜੀਰਾਂ ਵਿੱਚ ਬੰਨ੍ਹੀ ਰੱਖਿਆ ਹੈ ਪੁਰਾਣੇ ਸਮੇਂ ਵਿੱਚ ਕੁੜੀ ਦਾ ਪੈਦਾ ਹੋ ਜਾਣਾ ਹੀ ਘਰ ਦੀ ਨਮੋਸ਼ੀ ਲੈ ਕੇ ਆਉਂਦਾ ਸੀ ਪਹਿਲਾਂ ਕੁੜੀਆਂ ਪੈਦਾ ਹੋਣ ਤੋਂ ਬਾਅਦ ਵਿੱਚ ਮਾਰੀਆਂ ਜਾਂਦੀਆਂ ਸਨ ਅੱਜ ਭਰੂਣ ਹੱਤਿਆ ਦੀ ਵੱਧ ਰਹੀ ਬਿਮਾਰੀ ਵੀ ਇਸ ਗੱਲ ਦਾ ਸੰਕੇਤ ਹੈ ਵਿਗਿਆਨਿਕ ਤਰੱਕੀ ਨਾਲ ਡਾਕਟਰੀ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਨੇ ਅਜਿਹੇ ਯੰਤਰ ਪ੍ਰਦਾਨ ਕੀਤੇ ਕਿ ਲੜਕੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ ਕੁੜੀਆਂ ਦੀ ਗਿਣਤੀ ਘੱਟਣ ਨਾਲ ਸਿੱਟੇ ਵੱਜੋਂ ਲਿੰਗ ਅਨੁਪਾਤ ਵਿਚਲਾ ਫਰਕ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਭਾਵੇਂ ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਔਰਤ ਮਰਦ ਵਿਚਲਾ ਅਨੁਪਾਤ ਅੱਗੇ ਤੋਂ ਘੱਟ ਰਿਹਾ ਹੈ ਪਰ ਕਿੰਨੀ ਸੋਚਣ ਦੀ ਗੱਲ ਹੈ ਕਿ ਪੀਰਾਂ ਫਕੀਰਾਂ ਦੀ ਧਰਤੀ 'ਤੇ ਭਰੂਣ ਹੱਤਿਆ ਦਾ ਕਹਿਰ ਸਰਕਾਰ ਨੇ ਭਾਵੇਂ ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਕਈ ਸਖਤ ਕਦਮ ਉਠਾਏ ਹਨ ਪਰ ਹੁਣ ਘਟਨਾਵਾਂ ਹੋਰ ਤਰ੍ਹਾਂ ਵਾਪਰ ਰਹੀਆਂ ਹਨ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਨੰਨ੍ਹੀਆਂ ਬੱਚੀਆਂ ਕਿਤੇ ਸਟੇਸ਼ਨ ਬੱਸ ਅੱਡੇ ਅਤੇ ਸੁੰਨਸਾਨ ਥਾਵਾਂ 'ਤੇ ਪਈਆਂ ਮਿਲਦੀਆਂ ਹਨ ਪੰਜਾਬ ਵਿੱਚ ਯਤੀਮ ਖਾਨਿਆਂ ਵੱਲ ਝਾਤੀ ਮਾਰੀਏ ਤਾਂ ਉੱਥੇ ਪਲ ਰਹੇ ਨਿਆਸਰੇ ਬੱਚਿਆਂ ਵੱਜੋਂ ਜ਼ਿਆਦਾਤਰ ਕੁੜੀਆਂ ਹਨ ਇੱਥੋਂ ਇਹ ਸਾਹਮਣੇ ਆਉਂਦਾ ਹੈ ਕਿ ਔਰਤ ਦੀ ਮਰਦ ਪ੍ਰਧਾਨ ਸਮਾਜ ਵਿੱਚ ਕਿੰਨੀ ਕੁ ਕਦਰ ਹੈ ਕੁੜੀਆਂ ਭਾਵੇਂ ਹਰ ਖੇਤਰ ਵਿੱਚ ਮੁੰਡਿਆਂ ਤੋਂ ਅੱਗੇ ਨਿਕਲ ਰਹੀਆਂ ਹਨ ਅੱਜ ਕੱਲ੍ਹ ਆ ਰਹੇ ਪੇਪਰਾਂ ਨੇ ਦੇ ਨਤੀਜੇ ਮੂੰਹੋਂ ਬੋਲਦੇ ਹਨ ਜਦੋਂ ਅਸੀਂ ਪੜ੍ਹਾਈ ਦੇ ਮਾਮਲੇ ਵਿੱਚ ਜਾਇਜ਼ਾ ਲੈਂਦੇ ਹਾਂ ਤਾਂ ਦੇਸ਼ ਭਰ ਵਿੱਚ ਔਰਤਾਂ ਦੀ ਕੁੱਲ ਸੰਖਿਆ ਸਿਰਫ ਪੰਜਾਹ ਫੀਸਦੀ ਔਰਤਾਂ ਹੀ ਖੜ੍ਹੀਆਂ ਹੋਈਆਂ ਹਨ ਪੰਜਵੀਂ ਤੋਂ ਬਾਅਦ ਪੜ੍ਹਾਈ ਵਿੱਚ ਕੁੜੀਆਂ ਦੀ ਸੰਖਿਆ ਲਗਾਤਾਰ ਘੱਟਦੀ ਜਾਂਦੀ ਹੈ ਸਿਰਫ ਮੱਧ ਵਰਗ ਜਾਂ ਉੱਚ ਵਰਗ ਦੀਆਂ ਕੁੜੀਆਂ ਹੀ ਯੂਨੀਵਰਸਿਟੀ ਤੱਕ ਪਹੁੰਚਦੀਆਂ ਹਨ ਆਮ ਸਧਾਰਨ ਪਰਿਵਾਰ ਵਿੱਚ ਅਜੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਕੁੜੀ ਨੇ ਤਾਂ ਅਗਲੇ ਘਰ ਪਹੁੰਚ ਜਾਣਾ ਹੈ ਜੇ ਅੱਗਾ ਸਵਾਰਨਾ ਹੈ ਤਾਂ ਮੁੰਡੇ ਨੂੰ ਪੜ੍ਹਾਇਆ ਜਾਵੇ ਅਸੀਂ ਜਦੋਂ ਕਾਲਜ ਵਿੱਚ ਦਾਖਲਾ ਕਰ ਰਹੇ ਸੀ ਤਾਂ ਪਲੱਸ ਵਨ ਵਿੱਚ ਦਾਖਲਾ ਦਵਾਉਣ ਆਏ ਆਪਣੀਆਂ ਕੁੜੀਆਂ ਬਾਰੇ ਬਹੁਤੇ ਮਾਪੇ ਇਹੀ ਕਹਿ ਰਹੇ ਸਨ ਉਹਨਾਂ ਵਿੱਚ ਸਮੇਂ ਦੇ ਦੌਰ ਨਾਲ ਅਜੇ ਵੀ ਜਾਗਰਤੀ ਨਹੀਂ ਆਈ ਜੋ ਕੁੜੀਆਂ ਮਿਹਨਤ ਕਸ਼ ਮਜ਼ਦੂਰਾਂ ਦੇ ਘਰਾਂ ਵਿੱਚ ਪੈਦਾ ਹੁੰਦੀਆਂ ਹਨ ਉਹਨਾਂ ਦੇ ਮਸਲੇ ਹੋਰ ਹੁੰਦੇ ਹਨ ਇਹ ਔਰਤਾਂ ਅਤੇ ਕੁੜੀਆਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਲਈ ਘਰਾਂ ਤੋਂ ਬਾਹਰ ਜਾ ਕੇ ਮਜ਼ਦੂਰੀ ਕਰਦੀਆਂ ਹਨ ਜੋ ਔਰਤਾਂ ਅਤੇ ਕੁੜੀਆਂ ਫੈਕਟਰੀਆਂ ਜਾਂ ਹੋਰ ਖੇਤਰਾਂ ਵਿੱਚ ਕੰਮ ਕਰਦੀਆਂ ਹਨ ਇੱਕ ਤਾਂ ਉਹਨਾਂ ਤੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਹੈ ਉਹਨਾਂ ਨੂੰ ਉਜਰਤ ਮਰਦਾਂ ਦੇ ਮੁਕਾਬਲੇ ਘੱਟ ਦਿੱਤੀ ਜਾਂਦੀ ਹੈ ਇਹ ਅਕਸਰ ਮਰਦਾਂ ਦੇ ਮੁਕਾਬਲੇ ਪੰਜਾਹ ਤੋਂ ਪੈਂਹਠ ਪਰਸੈਂਟ ਤੱਕ ਦਿੱਤੀ ਜਾਂਦੀ ਹੈ ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ ਲਈ ਸਮਾਂ ਵੀ ਨਿਸ਼ਚਿਤ ਨਹੀਂ ਹੈ ਕਈ ਵਾਰੀ ਉਹਨਾਂ ਨੂੰ ਬਿਜਾਈ ਅਤੇ ਕਟਾਈ ਸਮੇਂ ਬਾਰ੍ਹਾਂ ਤੋਂ ਪੰਦਰ੍ਹਾਂ ਘੰਟੇ ਤੱਕ ਕੰਮ ਕਰਨਾ ਪੈਂਦਾ ਹੈ ਇਹ ਔਰਤਾਂ ਜਿੱਥੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਬਹੁਤ ਵਾਰੀ ਇਹ ਸਰੀਰਿਕ ਸ਼ੋਸ਼ਣ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ ਫਿਰ ਵੀ ਇਸ ਸਮਾਜ ਵਿੱਚ ਔਰਤਾਂ ਨੂੰ ਦੂਜੇ ਦਰਜੇ ਦੀ ਮੰਨਿਆ ਜਾਂਦਾ ਹੈ ਭਾਵੇਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਔਰਤ ਦੀ ਸਥਿਤੀ ਖੁਸ਼ਹਾਲ ਹੋ ਗਈ ਹੈ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਦਲਿੱਤ ਸ਼੍ਰੇਣੀਆਂ ਦੀਆਂ ਔਰਤਾਂ ਦਿਹਾੜੀ ਕਰਦੀਆਂ ਹਨ ਅਤੇ ਅੱਤ ਦੀ ਗਰੀਬੀ ਭੋਗਦੇ ਹੋਏ ਇਹ ਪਰਿਵਾਰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਹਨ ਬੇਸ਼ੱਕ ਔਰਤ ਨੇ ਮਜ਼ਦੂਰਾਂ ਦੀ ਫੌਜ ਨੂੰ ਵੱਡਾ ਕੀਤਾ ਹੈ ਪਰ ਖੇਤੀ ਜਾਂ ਗੈਰ ਖੇਤੀ ਖੇਤਰ ਵਿੱਚ ਔਰਤਾਂ ਨੂੰ ਉਹੀ ਕੰਮ ਮਿਲਦਾ ਹੈ ਜੋ ਘੱਟ ਮਜ਼ਦੂਰੀ ਦਾ ਹੋਵੇ ਅਸੀਂ ਸਿਹਤ ਖੇਤਰ ਦੀਆਂ ਮਿਲੀਆਂ ਰਿਪੋਰਟਾਂ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੁੜੀਆਂ ਤੋਂ ਲੈ ਕੇ ਔਰਤ ਤੱਕ ਸੱਠ ਪ੍ਰਤੀਸ਼ਤ ਤੋਂ ਵੱਧ ਵਿੱਚ ਇਹਨਾਂ ਔਰਤਾਂ ਵਿੱਚ ਖੂਨ ਦੀ ਕਮੀ ਪਾਈ ਜਾਂਦੀ ਹੈ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਡਿਪਰੈਸ਼ਨ ਦੀ ਬਿਮਾਰੀ ਨੇ ਘੇਰੀਆਂ ਹਨ ਕਿਉਂਕਿ ਉਹਨਾਂ ਨੂੰ ਸਮਾਜ ਵਿੱਚ ਸਵੱਸਥ ਅਤੇ ਨਰੋਇਆ ਵਾਤਾਵਰਨ ਨਹੀਂ ਮਿਲ ਰਿਹਾ ਉਹ ਇਸ ਮਾਨਸਿਕ ਦੁਵਿਧਾ ਵਿੱਚ ਘਿਰੀਆਂ ਆਪਣੇ ਆਪ ਨੂੰ ਚਿੰਤਾ ਦੇ ਦਰਿਆ ਵਿੱਚ ਸੁੱਟ ਰਹੀਆਂ ਹਨ ਕਿ ਘਰ ਅਤੇ ਬਾਹਰ ਕੰਮ ਕਰਨ ਦੇ ਬਾਵਜੂਦ ਉਹਨਾਂ ਦੀ ਮਰਦਾਂ ਦੇ ਮੁਕਾਬਲੇ ਬਰਾਬਰੀ ਨਹੀਂ ਹੈ ਉਹਨਾਂ ਦੇ ਸਾਰੇ ਅਰਮਾਨ ਉਮੰਗਾਂ ਅਤੇ ਇੱਛਾਵਾਂ ਅਧੂਰੀਆਂ ਜਾਪਦੀਆਂ ਹਨ ਅੱਜ ਬਹੁਤ ਸਾਰੀਆਂ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ ਔਰਤ ਦੀ ਅੱਜ ਸਥਿਤੀ ਅਜਿਹੇ ਮੋੜ 'ਤੇ ਖੜ੍ਹੀ ਹੈ ਜਿੱਥੇ ਔਰਤ ਦੇ ਵਿਕਾਸ ਦੀ ਸਾਰਥਿਕਤਾ ਦੇਖਣ ਦੀ ਜ਼ਰੂਰਤ ਹੈ ਔਰਤ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਮਰਦ ਪ੍ਰਧਾਨ ਸਮਾਜ ਦੇ ਅਧੀਨਤਾ ਹੇਠ ਵਿਚਰ ਰਹੀਆਂ ਹਨ